ਹਾਂਜੀ ਨਮਸਤੇ ਮੈ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਜਿੱਦਾਂ ਕਿ ਸਾਡੇ ਜਿੱਦਾਂ ਮਤਲਬ ਕਿ ਸੈਲਾਨੀ ਦੂਰ ਦੂਰ ਤੋਂ ਮਤਲਬ ਘੁੰਮਣ ਵਾਸਤੇ ਆਉਂਦੇ ਹਨ ਅਤੇ ਅਸੀਂ ਜਿੱਦਾਂ ਜਾਣਾ ਹੋਏ ਅਤੇ ਅਸੀਂ ਵੱਧ ਤੋਂ ਵੱਧ ਜਿੱਦਾਂ ਕਿ ਘੁੰਮਣ ਜਾਣਾ ਹੋਏ ਅਤੇ ਪਠਾਨਕੋਟ ਮਾਡਲ ਟਾਊਨ ਜਾਣਾ ਹੋਏ ਅਤੇ ਜਿੱਦਾਂ ਕਿ ਅਸੀਂ ਮੁਕੇਸਰਾਂ ਹੋ ਗਿਆ ਡੈਮ ਹੋ ਗਿਆ ਅਤੇ ਹਾਂਜੀ ਡੈਮ ਹੋ ਗਿਆ ਅਤੇ ਅਸੀਂ ਘੁੰਮਣ ਜਾਂਦੇ ਹਾਂ ਅਤੇ ਉਤਸ਼ਾਹ ਨਾਲ ਜਾਂਦੇ ਹਾਂ ਕਿ ਘੁੰਮਦੇ ਹਾਂ ਅਸੀਂ ਅਤੇ ਫਿਰ ਜਿੱਦਾਂ ਕਿ ਸਾਡੇ ਇੱਥੇ ਕਿਸੇ ਨੇ ਘੁੰਮਣ ਵਗੈਰਾ ਜਾਣਾ ਹੋਏ ਅਤੇ ਜਿੱਦਾਂ ਬਜ਼ੁਰਗ ਹੋ ਗਏ ਭੈਣ ਭਰਾ ਛੋਟੇ ਛੋਟੇ ਬੱਚੇ ਹੋ ਗਏ ਅਤੇ ਸਾਡੇ ਘੁੰਮਣ ਜਾਣ ਵਾਸਤੇ ਇੱਥੇ ਮਤਲਬ ਕਿ ਹਰ ਇਨਸਾਨ ਕੋਲ ਆਪਣਾ ਸਾਧਨ ਤਾਂ ਨਹੀਂ ਹੁੰਦਾ ਅਤੇ ਅਸੀਂ ਕੋਸ਼ਿਸ਼ ਕੋਸ਼ਿਸ਼ ਹੋਏਗੀ ਕਿ ਕੋਈ ਬੱਸ ਹੋਏ ਬੱਸ ਵਿੱਚ ਬਹਿ ਕੇ ਸਾਰੇ ਜਣੇ ਘੁੰਮ ਫਿਰ ਕੇ ਆ ਸਕਦੇ ਹਨ ਅਤੇ ਸਾਰੇ ਜਣੇ ਆਪਣਾ ਮਨੋਰੰਜਨ ਕਰ ਸਕਦੇ ਹਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਇੱਕ ਇਨਸਾਨ ਨੂੰ ਘੁੰਮਣ ਫਿਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਕਿ ਜਿੱਦਾਂ ਛੋਟੇ ਛੋਟੇ ਚਿੜੀਆ ਘਰ ਹੋ ਗਏ ਜਿੱਦਾਂ ਜਿੱਦਾਂ ਪਾਰਕਾਂ ਵਿੱਚ ਸ਼ਾਮ ਨੂੰ ਮਤਲਬ ਕਿ ਬੰਦਾ ਘੁੰਮ ਫਿਰ ਕੇ ਆ ਸਕਦਾ ਹੈ ਹਾਂਜੀ ਧੰਨਵਾਦ ਜੀ ਮਿਹਰਬਾਨੀ